ਹੈਲੋ ਕਿਤੇ ਨਹੀਂ ਮੈਂ ਘਰ ਸੀ ਬਸ ਤੁਸੀਂ ਦੱਸੋ ਕਿੱਥੇ ਹੋ ਬਸ ਜੀ ਬਸ ਜੀ ਤੁਸੀਂ ਤੁਸੀਂ ਦੱਸੋ ਆਪਣਾ ਤੁਹਾਡੇ ਕਿਵੇਂ ਠੀਕ ਹੈ ਅੱਛਾ ਅੱਛਾ ਤੁਸੀਂ ਕਿੰਨੀ ਪਾਈ ਸੀ ਫਿਰ ਰੂੜੀ ਅੱਛਾ ਅੱਛਾ ਚਲੋ ਵਧੀਆ ਫਿਰ ਤੁਹਾਡੀ ਕਣਕ ਵਧੀਆ ਨਿਕਲ ਜਾਏਗੀ ਹਾਂਜੀ ਅੱਛਾ ਚਲੋ ਵਧੀਆ ਸਾਡੇ ਤਾਂ ਖਾਦਾਂ ਪਈਆਂ ਨੇ ਇੱਧਰ ਕਿੱਲੇ 'ਚ ਛੇ ਛੇ ਥੈਲੇ ਪੈ ਗਏ ਕਿੱਲੇ 'ਚ ਹਾਂ ਹੋਰ ਝਾੜ ਵਧੀਆ ਨਿਕਲ ਜਾਏਗਾ ਉਹਦੇ ਨਾਲ ਫਿਰ ਹਾਂਜੀ ਅੱਛਾ ਤੁਹਾਡੀ ਚਲੋ ਵਧੀਆ ਨਾ ਫਿਰ ਖਾਣ ਖੂਣ ਨੂੰ ਵਧੀਆ ਜੀ ਸਾਡੇ ਤਾਂ ਵਾਧੂ ਨੇ ਸਾਡੇ ਪਿੰਡ 'ਚ ਵਾਧੂ ਹੈਗੇ ਨੇ ਆਸਾਨੀ ਨਾਲ ਮਿਲ ਜਾਣਗੇ ਹਾਂ ਸਾਡੇ ਉੱਧਰ ਹੀ ਕਿੰਨੇ ਕਿੰਨੇ ਬੰਦਿਆਂ ਦੀ ਲੋੜ ਸੀ ਅੱਛਾ ਕੋਈ ਨਹੀਂ ਭੇਜ ਦਾਂਗੇ ਕਦੋਂ ਕਦੋਂ ਵੱਢਣੀ ਤੁਸੀਂ ਅੱਛਾ ਅੱਛਾ ਠੀਕ ਹੈ ਚਲੋ ਵਧੀਆ ਹੋਰ ਕਛ ਨਹੀਂ ਬਸ ਹੋਰ ਤਿਆਰੀਆਂ ਨੇ ਬਸ ਸਾਡੀਆਂ ਵੀ ਹੁਣ ਇੱਕ ਦੋ ਦਿਨਾਂ ਦੇ ਵਿੱਚ ਕੰਬਾਇਨ ਲਾ ਦਾਂਗੇ ਕੰਬਾਈਨ ਨਾਲ ਹੀ ਵੱਢਣੀ ਅਸੀਂ ਤਾਂ ਹਾਂ ਕੰਬਾਈਨ ਨਾਲ ਵੱਢਣੀ ਤੁਸੀਂ ਕਿਵੇਂ ਕਰਨਾ ਅੱਛਾ ਅੱਛਾ ਜਿਹੜੇ ਉਹ ਬੰਦੇ ਭੇਜਣੇ ਨੇ ਉਹਨਾਂ ਤੋਂ ਉਹਨਾਂ ਤੋਂ ਵਢਾਣੀ ਨੇ ਅੱਛਾ ਅੱਛਾ ਠੀਕ ਤੁਹਾਡੇ ਉੱਥੇ ਰੇਟ ਰੂਟ ਕਿਵੇਂ ਨੇ ਕਣਕ ਦੇ ਐਤਕੀਂ ਅੱਛਾ ਹੁਣ ਤਾਂ ਵਾਢੀ ਤਾਂ ਹੋ ਗਈਆਂ ਹੋਣੀਆਂ ਤੁਹਾਡੇ ਉੱਥੇ ਕਿ ਨਹੀਂ ਅਜੇ ਸਟਾਰਟ ਅੱਛਾ ਹਾਲੇ ਹੋਈਆਂ ਨਹੀਂ ਸ਼ੁਰੂ ਠੀਕ ਠੀਕ ਹੈ ਚਲੋ ਚੰਗਾ ਠੀਕ ਚੰਗਾ ਓਕੇ ਓਕੇ ਓ